ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਹੋਰ ਤੁਸੀਂ ਮੋਹਾਲੀ ਤੋਂ ਬੋਲਦੇ ਹੈ ਜੀ ਮੈਮ ਮੈਂ ਅਸੀਂ ਮੋਹਾਲੀ ਘੁੰਮਣ ਆਉਣਾ ਹੈ ਜੀ ਇੱਥੇ ਮਤਲਬ ਕਿਹੜੇ ਕਿਹੜੇ ਢਾਬੇ ਵਧੀਆ ਹੈ ਕਿਤੇ ਫਿਰ ਵੀ ਦੱਸੋ ਤੁਸੀਂ ਕਿਹੜੇ ਕਿਹੜੇ ਢਾਬੇ ਹੈ ਜੀ ਹਾਂਜੀ ਅੱ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਵ ਵਧੀਆ ਹੈ ਖਾਣਾ ਪੀਣਾ ਐਨ ਵਧੀਆ ਹੈ ਅਸੀਂ ਵੀ ਆਉਣਾ ਹੈ ਫਿਰ ਤੁਸੀਂ ਸਾਨੂੰ ਘੁੰਮਾ ਦੂੰਗੇ ਸਭ ਤੋਂ ਵਧੀਆ ਉੱਥੇ ਕਿਆ ਮਿਲਦਾ ਹੈ ਜੀ ਅੱਛਾ ਜੀ ਚੱਲੋ ਅਸੀਂ ਆਉਂਗੇ ਜੀ ਅਸੀਂ ਬ ਬ ਜ਼ਿਆਦਾ ਮਹਿੰਗੇ ਤਾਂ ਨਹੀਂ ਢਾਬੇ ਜੀ ਠੀਕ ਹੈ ਢਾਬੇ ਵੀ ਮਤਲਬ ਬਹੁਤ ਵਧੀਆ ਜ਼ਿਆਦਾ ਮਹਿੰਗੇ ਤਾਂ ਨਹੀਂ ਹੈਗੇ ਜੀ ਜ਼ਿਆਦਾ ਮਹਿੰਗੇ ਤਾਂ ਨਹੀਂ ਢਾਬੇ ਜੀ ਚੱਲੋ ਠੀਕ ਹੈ ਜੀ ਫਿਰ ਅਸੀਂ ਕੱਲ੍ਹ ਨੂੰ ਤੁਹਾਨੂੰ ਦੱਸੂਗੇ ਫ਼ੋਨ ਕਰਕੇ ਵੀ ਅਸੀਂ ਕਿਹੜੇ ਟਾਈਮ ਆਉਣਾ ਹੈ ਅਸੀਂ ਤੁਹਾਡੇ ਨਾਲ ਏ ਜਾਉਂਗੇ ਜੀ